ਰੇਡੀਮੇਟ ਕੱਪੜੇ ਅਤੇ ਘਰ ਵਿੱਚ ਸੀਤੇ ਕੱਪੜਿਆਂ ਵਿੱਚ ਇਹ ਫਰਕ ਹੁੰਦਾ ਹੈ ਕਿ ਵੈਸੇ ਤਾਂ ਘਰ ਵਿੱਚ ਕਿ ਅਸੀਂ ਕੱਪੜੇ ਜਿਹੜੇ ਸਿਲਾਈ ਕਰਵਾਉਂਦੇ ਹਾਂ ਉਹ ਕੱਪੜਾ ਵੀ ਜਿਸ ਤਰ੍ਹਾਂ ਕਈ ਵਾਰੀ ਮਹਿੰਗਾ ਹੁੰਦਾ ਹੈ ਸਿਲਾਈ ਵੀ ਬਹੁਤ ਜ਼ਿਆਦਾ ਅੱਜ ਕੱਲ੍ਹ ਮਹਿੰਗੀ ਹੋ ਗਈ ਹੈ ਇਸ ਕਰਕੇ ਲੋਕ ਰੈਡੀਮੇਟ ਕੱਪੜੇ ਪਸੰਦ ਕਰਦੇ ਹਨ ਕਿ ਰੈਡੀਮੇਟ ਕੱਪੜਾ ਥੋੜ੍ਹਾ ਸਸਤਾ ਪੈ ਜਾਂਦਾ ਹੈ ਅਤੇ ਇਸ ਲਈ ਇਹ ਦੋਨਾਂ ਵਿੱਚ ਫਰਕ ਹੈ ਅਤੇ ਫਿਰ ਵੀ ਮਤਲਬ ਕਿ ਲੋਕ ਜਿਹੜੇ ਕਈ ਤਾਂ ਫਿਰ ਵੀ ਹੱਥ ਦੀ ਸਿਲਾਈ ਹੀ ਪਸੰਦ ਕਰਦੇ ਹਨ ਅਤੇ ਕਈ ਲੋਕ ਰੈਡੀਮੇਟ ਪਸੰਦ ਕਰਦੇ ਹਨ ਇਸ ਲਈ ਰੈਡੀਮੇਟ ਅਤੇ ਸਿਲਾਈ ਦੇ ਵਿੱਚ ਇਹ ਫਰਕ ਹੈ ਅਤੇ ਬਾਕੀ ਸਾਨੂੰ ਥੋੜ੍ਹਾ ਮਹਿੰਗਾ ਪੈਂਦਾ ਹੈ ਘਰ ਵਿੱਚ ਕੱਪੜਾ ਖਰੀਦ ਕੇ ਸਿਲਾਈ ਕਰਵਾਉਣਾ ਅਤੇ ਬਾਹਰ ਸਸਤਾ ਪੈ ਜਾਂਦਾ ਹੈ ਨਾਲ ਉਸ ਘੜੀ ਅਸੀਂ ਮਤਲਬ ਕਿ ਰੇਡੀਮੇਟ ਲਿਆ ਕੇ ਤੁਸੀਂ ਪਾ ਸਕਦੇ ਹੋ ਅਤੇ ਫਿਰ ਵੀ ਸਾਨੂੰ ਮਤਲਬ ਕਿ ਆਪਣੇ ਘਰ ਵਿੱਚ ਸਿਲਾਈ ਕਰਕੇ ਹੀ ਕੱਪੜਾ ਪਾਉਣਾ ਚਾਹੀਦਾ ਹੈ ਵਧੀਆ ਰਹਿੰਦਾ ਹੈ